ਅੱਜ ਕੱਲ੍ਹ ਭਾਰਤ ਸਰਕਾਰ ਆਪਣੇ ਰਾਜ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਲੜਕੀਆਂ ਨੂੰ ਸਾਈਕਲਾਂ ਦੇ ਰਹੀ ਹੈ ਜੋ ਕਿ ਬਹੁਤ ਹੀ ਵਧੀਆ ਸਕੀਮ ਹੈ ਜੋ ਕਿ ਕੰਮ ਕਰਦੀ ਹੈ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਦੂਰ ਤੋਂ ਸਕੂਲ ਪੈਦਲ ਤੁਰ ਕੇ ਅਉਂਦੀਆਂ ਹਨ ਜਿਸ ਕਰਕੇ ਉਹਨਾਂ ਨੂੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਸਾਈਕਲਾਂ ਲੜਕੀਆਂ ਨੂੰ ਦਿੱਤੀਆਂ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਲੜਕੀਆਂ ਆਰਾਮ ਦੇ ਨਾਲ ਸਾਈਕਲ ਦੇ ਉੱਤੇ ਆਪਣੇ ਸਕੂਲ ਉੱਤੇ ਟਾਈਮ 'ਤੇ ਆ ਸਕਣਗੀਆਂ ਕਿਉਂਕਿ ਕਈ ਲੜਕੀਆਂ ਬਹੁਤ ਜ਼ਿਆਦਾ ਦੂਰ ਹੋਣ ਕਾਰਨ ਸਕੂਲ ਲੇਟ ਪਹੁੰਚਦੀਆਂ ਹਨ ਜਿਹਨਾਂ ਕਰਕੇ ਉਹਨਾਂ ਦੀ ਸਿੱਖਿਆਵਾਂ 'ਤੇ ਅਸਰ ਪੈਂਦਾ ਹੈ ਇਸ ਕਰਕੇ ਇਹ ਬਹੁਤ ਹੀ ਵਧੀਆ ਸਕੀਮ ਹੈ